ਪੰਜ ਪਰਸਨਸ ਦੇ ਨੇਮ ਜੀ ਜਿਹੜੇ ਮੇਰੇ ਆਸੇ ਪਾਸੇ ਰਹਿੰਦੇ ਹੈ ਗਗਨ ਬਾਂਸਲ ਜੀ ਲਵ ਗੋਇਲ ਜੀ ਨਰਿੰਦਰ ਪਾਲ ਸਿੰਘ ਜੀ ਤਜਿੰਦਰ ਸਿੰਘ ਜੀ ਸੁਪਨਦੀਪ ਸਿੰਘ ਜੀ ਹੋ ਗਏ ਜੀ ਪੰਜ ਤਾਂ